ਧਾਰਮਿਕ ਤਿਉਹਾਰਾਂ ਦੇ ਮੌਕਿਆਂ 'ਤੇ ਕਈ ਤਰ੍ਹਾਂ ਦੀਆਂ ਧਾਰਮਿਕ ਮੂਰਤੀਆਂ ਦੀ ਸਥਾਪਨਾ ਕੀਤੀ ਜਾਂਦੀ ਹੈ ਅਤੇ ਕਈ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਉਹਨਾਂ ਵਿੱਚੋਂ ਮੈਂ ਮੁੱਖ ਗਣੇਸ਼ ਜੀ ਦੀ ਮੂਰਤੀ ਨੂੰ ਦਿੱਤਾ ਸੀ ਸਭ ਤੋਂ ਪਹਿਲਾਂ ਮੈਂ ਚੀਕਣੀ ਮਿੱਟੀ ਲਿਆਇਆ ਅਤੇ ਉਸ ਨੂੰ ਗਿੱਲ੍ਹਾ ਕਰਕੇ ਗਣੇਸ਼ ਮਹਾਰਾਜ ਜੀ ਦੀ ਆਕਾਰ ਮੂਰਤੀ ਤਿਆਰ ਕਰ ਲਈ ਉਸ ਤੋਂ ਬਾਅਦ ਉਸ ਨੂੰ ਅਲੱਗ ਅਲੱਗ ਤਰ੍ਹਾਂ ਦੇ ਕਲਰਾਂ ਨਾਲ਼ ਭਰਿਆ ਗਿਆ ਅਤੇ ਮੈਂ ਉਸ ਮੂਰਤੀ ਨੂੰ ਪੂਰੀ ਤਰ੍ਹਾਂ ਆਕਾਰ ਦੇ ਦਿੱਤਾ ਫ਼ਿਰ ਉਸਨੂੰ ਉਸ ਤੋਂ ਬਾਅਦ ਮੈਂ ਇੱਕ ਮੰਦਰ ਵਿੱਚ ਰੱਖ ਦਿੱਤਾ ਅਤੇ ਮੈਂ ਉਸ ਮੂਰਤੀ ਨੂੰ ਬਹੁਤ ਹੀ ਚੰਗੇ ਢੰਗ ਨਾਲ਼ ਬਣਾਇਆ